ਫ਼ੈਸਲਿਆਂ ਦੇ ਵਿੱਚੋਂ ਮੇਰਾ ਮੈਨੂੰ ਇੱਕ ਜਿਹੜਾ ਮਹੱਤਵਪੂਰਨ ਫ਼ੈਸਲਾ ਲੱਗਦਾ ਉਹ ਮੇਰੀ ਪੜ੍ਹਾਈ ਬਾਰੇ ਆ ਜਦੋਂ ਮੈਂ ਪਲਸ ਟੂ ਕਮਰਸ ਦੇ ਵਿੱਚ ਕਰਕੇ ਹਟਿਆ ਤਾਂ ਉਸ ਟਾਈਮ ਮੈਂ ਸੀ ਪੀ ਟੀ ਦੀ ਤਿਆਰੀ ਕੀਤੀ ਜਿਹੜੀ ਕਿ ਐਂਟਰੈਂਸ ਐਗਜ਼ਾਮ ਹੁੰਦਾ ਸੀ ਏ ਕਰਨ ਵਾਸਤੇ ਅਤੇ ਮੈਂ ਐਂਟਰੈਂਸ ਐਗਜ਼ਾਮ ਮੇਰਾ ਜਦੋਂ ਕਲੀਅਰ ਹੋ ਗਿਆ ਤਾਂ ਮੈਨੂੰ ਇਹ ਸੀਗਾ ਕਿ ਮੈਂ ਸੀ ਏ ਕਰ ਲੈਂਦਾ ਹੈ ਨਾ ਟ੍ਰਾਈ ਕਰ ਲੈਂਦਾ ਜੇ ਹੋ ਗਈ ਠੀਕ ਹੈ ਹੈ ਨਾ ਅਤੇ ਨਾਲ਼ ਨਾਲ਼ ਆਪਾਂ ਬੀ ਕੌਮ ਕਰ ਲਵਾਂਗੇ ਅਤੇ ਬੀ ਕੌਮ ਮੈਂ ਕੋਰਸਪੋਂਡਸ ਮਤਲਬ ਕਿ ਪ੍ਰਾਈਵੇਟ ਕਹਿ ਦਿੰਦੇ ਹਾਂ ਆਪਾਂ ਪ੍ਰਾਈਵੇਟ ਭਰਤੀ ਉਹ ਪੰਜਾਬੀ ਯੂਨੀਵਰਸਿਟੀ ਅਤੇ ਪਰ ਮੈਨੂੰ ਮੇਰੇ ਦੋਸਤ ਨੇ ਇਨਸਿਸਟ ਕੀਤਾ ਮਤਲਬ ਉਹਨਾਂ ਨੇ ਥੋੜ੍ਹਾ ਜਿਹਾ ਮੈਨੂੰ ਜ਼ੋਰ ਪਾ ਕੇ ਕਿਹਾ ਵੀ ਤੂੰ ਰੈਗੂਲਰ ਕੋਲੇਜਾਂ ਲਈ ਵੀ ਅਪਲਾਈ ਕਰ ਅਤੇ ਫਿਰ ਮੈਂ ਪਨ ਪਟ ਪਟਿਆਲੇ ਦੇ ਕੁਛ ਕੋਲੇਜਾਂ ਦਾ ਅਪਲਾਈ ਕੀਤਾ ਚੰਡੀਗੜ੍ਹ ਅਪਲਾਈ ਕੀਤਾ ਪੰਜਾਬੀ ਯੂਨੀਵਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਤੇ ਆਪਣਾ ਮੇਰਾ ਇੱਥੇ ਪਟਿਆਲੇ ਤਾਂ ਮੈਨੂੰ ਕਿਤੇ ਐਡਮਿਸ਼ਨ ਔਫਰ ਮਿਲੀ ਨਹੀਂ ਹੈਗੀ ਅਤੇ ਕਿਉਂਕਿ ਮੈਂ ਕੁਛ ਲੇਟ ਹੋ ਗਿਆ ਭਰਨ ਦੇ ਵਿੱਚ ਹੈ ਨਾ ਜਿਵੇਂ ਕਿ ਖਾਲਸਾ ਕੋਲੇਜ ਫੋਰਮ ਬੰਦ ਹੋ ਗਏ ਅਤੇ ਬਿਕਰਮ ਕਾਲਜ ਕੱਟਔਫ ਜ਼ਿਆਦੇ ਚਲੀ ਗਈ ਅਤੇ ਫੇਰ ਚੰਡੀਗੜ੍ਹ ਯੂਨੀਵਰਸਿਟੀ ਸਾਰੇ ਕੋਲੇਜ ਉੱਧਰ ਵੀ ਫਿੱਲ ਹੋ ਗਏ ਸੀ ਕਾਊਂਸਲਿੰਗਾਂ 'ਚ ਮੈਨੂੰ ਕਿਤੇ ਐਡਮਿਸ਼ਨ ਨਹੀਂ ਮਿਲੀ ਪਰ ਆਖਿਰਕਾਰ ਐਟ ਐਂਡ ਮੈਨੂੰ ਜਦੋਂ ਐਡਮਿਸ਼ਨਾਂ ਦੇ ਕੁਛ ਆਖਰੀ ਦਿਨ ਸੀ ਤਾਂ ਕੋਈ ਸੀਟ ਖ਼ਾਲੀ ਹੋ ਗਈ ਤਾਂ ਮੈਂ ਆਖਰੀ ਕਾਊਂਸਲਿੰਗ 'ਤੇ ਚਲਿਆ ਗਿਆ ਅਤੇ ਉੱਥੇ ਮੈਨੂੰ ਜੀ ਸੀ ਸੀ ਵੀ ਏ ਚੰਡੀਗੜ੍ਹ ਦੇ ਵਿੱਚ ਐਡਮਿਸ਼ਨ ਮਿਲੀ ਫਿਰ ਉੱਥੋਂ ਮੈਂ ਅੱਪ ਡਾਊਨ ਕਰਦਾ ਸੀ ਥੋੜ੍ਹਾ ਜਿਹਾ ਖੇਚਲ ਤਾਂ ਹੁੰਦੀ ਸੀ ਪਰ ਇਹ ਹੈ ਕਿ ਮੈਨੂੰ ਲੱਗਿਆ ਕਿ ਉਹ ਮੇਰਾ ਫ਼ੈਸਲਾ ਮਹੱਤਵਪੂਰਨ ਸੀ ਮੇਰੇ ਦੋਸਤਾਂ ਬਾਰੇ ਅਤੇ ਉਹਨਾਂ ਨੇ ਮੇਰੀ ਸਲਾਹ ਜੋ ਮ ਮੈਨੂੰ ਦਿੱਤੀ ਉਹ ਮੇਰੇ ਕੰਮ ਆਈ ਅਤੇ ਮੈਂ ਬੀ ਕੌਮ ਫਿਰ ਜਿਹੜੀ ਰੈਗੂਲਰ ਕੀਤੀ ਉਹਨੇ ਮੈਨੂੰ ਬਹੁਤ ਕੁਝ ਚੰਗਾ ਸਿਖਾਇਆ